ਜਦੋਂ ਮੈਂ ਸ਼ੁਰੂ ਸ਼ੁਰੂ ਦੇ ਵਿੱਚ ਖਾਣਾ ਬਣਾਉਣਾ ਸ਼ੁਰੂ ਕੀਤਾ ਸੀ ਤਾਂ ਮੇਰੇ ਨਾਲ ਬਹੁਤ ਸਾਰੇ ਹਾਦਸੇ ਹੋਏ ਜਿਹਦੇ ਕਰਕੇ ਮੇਰੇ ਕਾਫ਼ੀ ਸੱਟਾਂ ਲੱਗੀਆਂ ਪਰ ਹੌਲੀ ਹੌਲੀ ਮੈਂ ਉਹਨਾਂ ਸਾਰੀਆਂ ਆਫ਼ਤਾਂ ਤੋਂ ਬਚੀ ਅਤੇ ਫੇਰ ਇੱਕ ਤਾਂ ਮੇਰੇ ਨਾਲ ਇੰਨਾ ਹੀ ਬੜਾ ਭਿਆਨਕ ਹਾਦਸਾ ਹੋਇਆ ਸੀਗਾ ਕਿ ਮੈਂ ਮਤਲਬ ਰੋ ਚਾਹ ਬਣਾ ਰਹੀ ਸੀਗੀ ਅਤੇ ਚਾਹ ਬਣਾਉਂਦੇ ਬਣਾਉਂਦੇ ਮੈਂ ਚਾਹ ਛੱਡ ਕੇ ਦੂਸਰੀ ਜਗ੍ਹਾ 'ਤੇ ਚਲੀ ਗਈ ਅਤੇ ਫ਼ੋਨ ਦੇਖਣ ਲੱਗ ਗਈ ਫ਼ੋਨ ਦੇਖਦੇ ਦੇਖਦੇ ਮੈਨੂੰ ਯਾਦ ਹੀ ਨਹੀਂ ਰਿਹਾ ਕਿ ਮੈਂ ਚਾਹ ਵੀ ਰੱਖੀ ਹੈ ਅਤੇ ਚਾਹ ਦਾ ਚਾਹ ਦੇ ਪਤੀਲੇ ਦਾ ਸੱਤਿਆਨਾਸ ਹੋ ਗਿਆ ਸੀਗਾ ਫੇਰ ਜਦੋ ਮੈਂ ਆ ਕੇ ਦੇਖਿਆ ਅਤੇ ਉਸ ਤੋਂ ਬਾਅਦ ਫੇਰ ਮੈਂ ਉਸਨੂੰ ਰਗੜ ਰਗੜ ਕੇ ਧੋਇਆ ਪਰ ਉਹ ਨਹੀਂ ਧੋ ਨਹੀਂ ਸਾਫ ਹੋਇਆ ਜਿਹਦੇ ਕਰਕੇ ਮੰਮਾ ਨੇ ਮੈਨੂੰ ਬਹੁਤ ਗਾਲਾਂ ਸੁਣਾਈਆਂ ਅਤੇ ਮੰਮਾ ਨੇ ਡਾਂਟਿਆ ਕਿ ਤੈਨੂੰ ਚਾਹ ਨਹੀਂ ਬਣਾਉਣੀ ਆਉਂਦੀ ਤੈਨੂੰ ਇਹ ਨਹੀਂ ਕਰਨਾ ਆਉਂਦਾ ਫਿਰ ਉਸ ਤੋਂ ਬਾਅਦ ਮੈਂ ਮੰਮਾ ਨੂੰ ਕਿਹਾ ਕਿ ਮੰਮਾ ਸੌਰੀ ਮੈਂ ਇਸ ਤੋਂ ਬਾਅਦ ਇਹੋ ਜਿਹੀ ਗਲਤੀ ਨਹੀਂ ਕਰੂੰਗੀ ਪਰ ਉਸ ਤੋਂ ਬਾਅਦ ਵੀ ਮੇਰੇ ਤੋਂ ਇ ਇੱਕ ਦੋ ਵਾਰ ਪਤੀਲਾ ਫੇਰ ਸੜ ਗਿਆ ਫਿਰ ਮੈਂ ਮਾਂਜ ਮਾਂਜ ਕੇ ਹੋਰ ਥੱਕ ਗਈ ਫਿਰ ਉਸ ਤੋਂ ਬਾਅਦ ਮੈਂ ਧਿਆਨ ਰੱਖਣਾ ਸ਼ੁਰੂ ਕਰਤਾ ਕਿ ਮੈਂ ਹੁਣ ਪਤੀਲੇ ਨਹੀਂ ਸਾੜੂੰਗੀ ਅਤੇ ਧਿਆਨ ਨਾਲ ਚਾਹ ਬਣਾਉਂਗੀ ਅਤੇ ਉਸ ਤੋਂ ਬਾਅਦ ਵੀ ਮੇਰੇ ਨਾਲ ਇੱਕ ਅਜਿਹਾ ਹਾਦਸਾ ਹੋਇਆ ਕਿ ਮੈਂ ਪੂਰੀਆਂ ਬਣਾਉਣ ਲੱਗੀ ਸੀ ਅਤੇ ਪੂਰੀਆਂ ਦਾ ਤੇਲ ਸੀਗਾ ਜੋ ਉਹ ਕਾਫੀ ਗਰਮ ਸੀਗਾ ਉਹ ਮੇਰੇ ਹੱਥ 'ਤੇ ਪੈ ਗਿਆ ਅਤੇ ਫਿਰ ਮੇਰੇ ਉੱਥੇ ਛਾਲਾ ਹੋ ਗਿਆ ਹੱਥ ਦੇ ਵਿੱਚ ਅਤੇ ਉਹ ਛਾਲਾ ਬਹੁਤ ਹੀ ਅਜੀਬ ਤਰੀਕੇ ਦਾ ਸੀ ਜਦੋਂ ਇੱਕ ਛਾਲਾ ਫੁੱਟ ਜਾਂਦਾ ਸੀ ਤਾਂ ਦੂਸਰਾ ਛਾਲਾ ਹੋ ਜਾਂਦਾ ਸੀ ਫਿਰ ਮੈਂ ਆਪਣੇ ਪਿੰਡ ਦੇ ਡਾਕਟਰ ਨਾਲ ਸਲਾਹ ਕੀਤੀ ਅਤੇ ਸਕਿੱਨ ਸ ਉੱਥੇ ਤੋਂ ਫਿਰ ਮੈਂ ਦਵਾਈਆਂ ਲੈਣੀਆਂ ਸ਼ੁਰੂ ਕਰਤੀਆਂ ਫਿਰ ਕੁਛ ਕੁ ਟਾਈਮ ਬਾਅਦ ਮੇਰੇ ਨਾਲ ਠੀਕ ਹੋ ਗਿਆ ਸੀਗਾ